ਹਾਂਜੀ ਮੇਰੀ ਮਨਪਸੰਦ ਖੇਡ ਖਿਡਾਰੀ ਹੈਗੀ ਹੈ ਪੀਵੀ ਸਿੰਧੂ ਅਤੇ ਪੀਵੀ ਸਿੰਧੂ ਮੈਨੂੰ ਖੁਦ ਬੈਡਮਿੰਟਨ ਪਸੰਦ ਹੈਗੀ ਹੈ ਅਤੇ ਔਰ ਐਸੇ ਕਰਕੇ ਮੈਂ ਪੀਵੀ ਸਿੰਧੂ ਦਾ ਜਿਹੜਾ ਮੈਚ ਹੈ ਜ਼ਰੂਰ ਦੇਖਦੀ ਆਂ ਔਰ ਉਹ ਉਹਦੇ ਤੋਂ ਮੈਂ ਕਾਫੀ ਇੰਸਪਾਇਰ ਹਾਂ ਉਹਦੇ ਉਹਦੇ ਕਾਫੀ ਗੁਣ ਹੈਗੇ ਹੈ ਜਿਹਨਾਂ ਦੇ ਇੱਕ ਦੋ ਤਿੰਨ ਗੁਣਾਂ ਦੇ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਦੇ ਮੈਂ ਕਾਫੀ ਪਸੰਦ ਕਰਦੀ ਹਾਂ ਕਿ ਇੱਕ ਤਾਂ ਉਹ ਸਾਰੀ ਦੁਨੀਆਂ ਸੁੱਤੀ ਹੁੰਦੀ ਹੈ ਅਤੇ ਉਹ ਚਾਰ ਵਜੇ ਆਪਣੇ ਫਾਦਰ ਦੇ ਨਾਲ ਆਪਣੀ ਪ੍ਰੈਕਟਿਸ ਕਰਨ ਜਾਂਦੀ ਹੈ ਇਹ ਉਹਦੀ ਲਗਨ ਦੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹਨੇ ਇੱਕ ਇੰਟਰਨੈਸ਼ਨਲ ਲੈਵਲ 'ਤੇ ਸਾਡੇ ਇੰਡੀਆ ਨੂੰ ਇੱਕ ਪਹਿਚਾਣ ਦਵਾਈ ਹੈ ਅਤੇ ਉਹਦੀ ਮਿਹਨਤ ਵੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਅਤੇ ਉਹਦਾ ਇੱਕ ਇੰਟਰਨੈਸ਼ਨਲ ਲੈਵਲ 'ਤੇ ਉਹਨੇ ਸਾਨੂੰ ਇੰਡੀਆ ਨੂੰ ਪੋਪਲੈਰਿਟੀ ਦਵਾਈ ਹੈ ਜਾਂ ਇੱਕ ਰਿਸਪੈਕਟ ਦਿੱਤੀ ਹੈ ਉਹ ਇਸ ਗੱਲ ਦੀ ਖੁਸ਼ੀ ਤਾਂ ਮੈਨੂੰ ਸਦਾ ਹੀ ਰਹੇਗੀ ਅਤੇ ਜੇ ਕਦੇ ਮੈਂ ਉਹਨਾਂ ਨੂੰ ਮਿਲੀ ਤਾਂ ਮੈਂ ਉਹਨਾਂ ਨੂੰ ਇਹ ਪੁੱਛਾਂਗੀ ਕਿ ਤੁਸੀਂ ਆਪਣੀ ਇਹ ਗੇਮ ਖੇਲਣ ਵਾਸਤੇ ਕਿਹਨੇ ਤੁਹਾਨੂੰ ਇੰਸਪਾਇਰ ਕੀਤਾ ਅਤੇ ਤੁਸੀਂ ਕਿਸ ਤਰ੍ਹਾਂ ਇਸ ਗੇਮ ਦੇ ਵਿੱਚ ਆਏ ਅਤੇ ਤੁਸੀਂ ਕਿਸ ਤਰ੍ਹਾਂ ਇਹ ਸਾਰਾ ਮੈਨੇਜ ਕਰਦੇ ਪਏ ਹੋ ਆਪਣੀ ਇਹਦੀ ਖੇਡ ਵਾਲੀ ਲਾਈਫ ਅਤੇ ਆਪਣੀ ਆਮ ਜ਼ਿੰਦਗੀ 'ਚ ਕਿਸ ਤਰ੍ਹਾਂ ਪੋਪਅਪ ਹੁੰਦਾ ਪਿਆ ਤੁਹਾਡਾ